ਖੇਤੀ ਉਦਯੋਗ ਦੇ ਸਾਹਮਣੇ ਚੁਣੌਤੀਆਂ ਹਨ ਕਿ ਲੋਕ ਨਾ ਹੁਣ ਅੱਜ ਕੱਲ੍ਹ ਔਰਗੈਨਿਕ ਖੇਤੀ ਤਾਂ ਕਰਦੇ ਨਹੀਂ ਹੈਗੇ ਬਹੁਤ ਜ਼ਿਆਦਾ ਰੇਹ ਸਪ੍ਰੇ ਬਹੁਤ ਜ਼ਿਆਦਾ ਯੂਜ਼ ਕਰਨ ਲੱਗ ਗਏ ਅਤੇ ਬਹੁਤ ਜ਼ਿਆਦਾ ਇਹ ਚੁਣੌਤੀਆਂ ਹੈਗੀਆਂ